ਹੈਲੋ ਹਾਂਜੀ ਹਾਂਜੀ ਹੈਲੋ ਸਰ ਸਰ ਮੈਂ ਨਾ ਆਪਣਾ ਇੱਕ ਖਾਤਾ ਖੁਲਵਾਉਣਾ ਤੁਹਾਡੇ ਬੈਂਕ ਦੇ ਵਿੱਚ ਸਰ ਮੈਨੂੰ ਦੱਸੋ ਕਿ ਤੁਹਾਡੇ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਨੇ ਸਰ ਮੈਂ ਪ੍ਰਾਈਵੇਟ ਕੰਮ ਕਰਦਾ ਜੀ ਸਰ ਮਲਟੀਨੈਸ਼ਨਲ ਕੰਪਨੀ ਹੈ ਜੀ ਤਨਖ਼ਾਹ ਮੇਰੀ ਹੈਗੀ ਬਾਰਾਂ ਹਜ਼ਾਰ ਜੀ ਹਾਂਜੀ ਆਧਾਰ ਕਾਰਡ ਬਣਿਆ ਹੋਇਆ ਜੀ ਪੈਨ ਕਾਰਡ ਨਹੀਂ ਬਣਿਆ ਹੋਇਆ ਜੀ ਪੈਨ ਕਾਰਡ ਦੀ ਪ੍ਰੋਬਲਮ ਇਹ ਹੈ ਜੀ ਮੇਰਾ ਨਾ ਜਨਮ ਸਰਟੀਫਿਕੇਟ ਨਹੀਂ ਬਣਿਆ ਹੋਇਆ ਪੈਨ ਕਾਰਡ ਬਣਾਉਣ ਲਈ ਉਹਦੇ 'ਚ ਜਨਮ ਸਰਟੀਫਿਕੇਟ ਦੀ ਸ਼ਰਤ ਹੈ ਅਤੇ ਉਹਦੇ ਕਰਕੇ ਉਹਦੇ ਹਾਂਜੀ ਜੀ ਠੀਕ ਹੈ ਜੀ ਠੀਕ ਹੈ ਜੀ ਆਧਾਰ ਕਾਰਡ ਬਣਿਆ ਹੋਇਆ ਅਸਲ 'ਚ ਨਾ ਜੀ ਮੇਰਾ ਬਰਥ ਸਰਟੀਫਿਕੇਟ ਨਹੀਂ ਬਣਿਆ ਹੋਇਆ ਜਦੋਂ ਮੈਂ ਐਪਲਾਈ ਕੀਤਾ ਸੀ ਤਾਂ ਉਹਦੇ ਉਬਜੈਕਸ਼ਨ ਲੱਗ ਗਿਆ ਸੀ ਕਿ ਬਰਥ ਸਰਟੀਫਿਕੇਟ ਲਗਾਉ ਹਾਂਜੀ ਸਰ ਜਨਮ ਤਰੀਕ ਭਰੀ ਹੋਈ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਜਿਹੜਾ ਜਿਹੜਾ ਮੇਰੇ ਪੈਨ ਕਾਰਡ 'ਤੇ ਜਿਹੜਾ ਮੇਰੇ ਪੈਨ ਕਾਰਡ 'ਤੇ ਉਬਜੈਕਸ਼ਨ ਲੱਗਿਆ ਸੀ ਉਹ ਲਿਆਵਾਂ ਜੀ ਠੀਕ ਹੈ ਜੀ ਅਤੇ ਇੱਕ ਮੈਨੂੰ ਇਹ ਦੱਸੋ ਜੀ ਜਿਹੜਾ ਤੁਸੀਂ ਖਾਤਾ ਖੋਲ੍ਹੋਂਗੇ ਮੇਰੇ ਖਾਤੇ ਵਿੱਚ ਘੱਟੋ ਘੱਟ ਕਿੰਨੇ ਪੈਸੇ ਰਹਿਣੇ ਚਾਹੀਦੇ ਨੇ ਉਹ ਕਈ ਵਾਰ ਨਾ ਮੈਨੂੰ ਨਾਲ ਦਿਆਂ ਨੇ ਡਰਾ ਦਿੱਤਾ ਕਹਿੰਦੇ ਜੀ ਘੱਟੋ ਘੱਟ ਖਾਤੇ ਵਿੱਚ ਪੰਜ ਹਜ਼ਾਰ ਰੁਪਿਆ ਰੱਖਣਾ ਚਾਹੀਦਾ ਵੀ ਕੀ ਜ਼ਰੂਰੀ ਹੈ ਇੱਦਾਂ ਦੀ ਕੋਈ ਸ਼ਰਤ ਹੈਗੀ ਹੈ ਠੀਕ ਹੈ ਜੀ ਠੀਕ ਹੈ ਜੀ ਚਲੋ ਫਿਰ ਮੈਂ ਨਾ ਤੁਹਾਡੇ ਕੋਲ ਕਦੋਂ ਆਵਾਂ ਜੀ ਡਾਕੂਮੈਂਟ ਲੈ ਕੇ ਆਪਣੇ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਸਰ ਜੀ ਧੰਨਵਾਦ ਉਕੇ ਉਕੇ ਜੀ ਉਕੇ ਥੈਂਕ ਯੂ